ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਮ ਅਸੀਂ ਰੋਪੜ ਤੋਂ ਗੱਲ ਕਰ ਰਹੇ ਹਾਂ ਕਮਲ ਦੀ ਹੱਟੀ ਤੋਂ ਅੱਛਾ ਜੀ ਮੈਮ ਤੁਸੀਂ ਕੀ ਓਕੇ ਮੈਮ ਤੁਸੀਂ ਕਿੰਨੀ ਕੁ ਰੇਂਜ ਤੱਕ ਦੇਖਣੀ ਚਾਹੁੰਦੇ ਹੋ ਹਾਂਜੀ ਮੈਮ ਸਾਡੇ ਕੋਲ ਨਾ ਅਲੱਗ ਅਲੱਗ ਵੈਰਾਇਟੀ ਦੀਆਂ ਜੁੱਤੀਆਂ ਚੱਪਲਾਂ ਅਤੇ ਸਪੋਰਟਸ ਸ਼ੂਜ਼ ਵੀ ਹੈਗੇ ਨੇ ਮਤਲਬ ਤੁਸੀਂ ਪੰਜਾਬੀ ਜੁੱਤੀ ਹਾਂਜੀ ਹਾਂਜੀ ਸਾਡੇ ਕੋਲ ਡੇਲੀ ਵੇਅਰਸ ਸਪੋਰਟਸ ਸ਼ੂਜ਼ ਵੀ ਹੈਗੇ ਨੇ ਅਤੇ ਤੁਸੀਂ ਫੈਸ਼ਨੇਬਲ ਜੇ ਤੁਸੀਂ ਵਿਆਹਵਾਂ ਸ਼ਾਦੀਆਂ 'ਤੇ ਪਾਉਣੇ ਨੇ ਅਤੇ ਉਹ ਵੀ ਸਾਡੇ ਕੋਲ ਅਵੈਲੇਬਲ ਹੈ ਸਾਡੀ ਤੁਸੀਂ ਤੁਹਾਨੂੰ ਦੁਕਾਨ ਤਾਂ ਪਤਾ ਹੀ ਹੋਵੇਗੀ ਕਮਲ ਦੀ ਹੱਟੀ ਜੋ ਕਿ ਰੋਪੜ ਬਾਜ਼ਾਰ ਦੇ ਵਿੱਚ ਹੈ ਅਤੇ ਪੰਜਾਬੀ ਜੁੱਤੀ ਵੀ ਸਾਡੇ ਕੋਲ ਅਵੈਲੇਬਲ ਹੈਗੀ ਹੈ ਅਲੱਗ ਅਲੱਗ ਤਰ੍ਹਾਂ ਦੀ ਤੁਸੀਂ ਸੂਟ ਦੇ ਨਾਲ ਮੈਚਿੰਗ ਵੀ ਲੈ ਸਕਦੇ ਹੋ ਅਸੀਂ ਰੈਡੀਮੇਡ ਬਣਵਾਉਂਦੇ ਵੀ ਹਾਂ ਹਾਂਜੀ ਹਾਂਜੀ ਟਰੈਂਡਿੰਗ ਪੰਜਾਬੀ ਜੁੱਤੀ ਨੇ ਅਤੇ ਉਹਦੇ 'ਤੇ ਐਮਬ੍ਰੋਆਈਡਰੀ ਵਰਕ ਵੀ ਅਸੀਂ ਕਰਵਾਉਂਦੇ ਹਾਂ ਹਾਂਜੀ ਹਾਂਜੀ ਹੀਲ ਵਾਲੀ ਵੀ ਹੈਗੀਆਂ ਨੇ ਅਲੱਗ ਅਲੱਗ ਡਿਜ਼ਾਇਨਜ਼ ਨੇ ਉਹਦੇ ਵਿੱਚ ਅਤੇ ਹੁਣ ਸਾਡੇ ਕੋਲ ਨਵੇਂ ਡਿਜ਼ਾਇਨ ਆਏ ਹੋਏ ਹੈ ਉਹ ਵਾਲੀਆਂ ਜਿਹੜੀਆਂ ਹੀਲ ਵਾਲੀਆਂ ਨੇ ਉਹ ਫਾਈਵ ਹੰਡਰੈੱਡ ਤੋਂ ਲੈ ਕੇ ਚਾਰ ਤੋਂ ਪੰਜ ਹਜ਼ਾਰ ਦੇ ਵਿੱਚ ਆਉਂਦੀਆਂ ਨੇ ਹਾਂਜੀ ਤੁਸੀਂ ਸਾਡੀ ਸ਼ੌਪ 'ਤੇ ਵੀਜ਼ਟ ਕਰ ਸਕਦੇ ਹੋ ਜਦ ਮਰਜ਼ੀ ਰੋਪੜ ਦੇ ਪੁੱਲ ਬਾਜ਼ਾਰ ਦੇ ਵਿੱਚ ਸਾਡੀ ਹੱਟੀ ਹੈ ਜੀ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਇਸ ਨੰਬਰ 'ਤੇ ਆਪ ਆਪਣਾ ਫੋਨ ਨੰਬਰ ਸਾਰਾ ਕੁਝ ਐਡਰੈੱਸ ਵਗੈਰਾ ਸੈਂਡ ਕਰ ਦੇਵਾਂਗੀ ਅਤੇ ਤੁਸੀਂ ਸਾਡੀ ਦੁਕਾਨ ਵਿੱਚ ਜ਼ਰੂਰ ਵੀਜ਼ਟ ਕਰੋ ਓਕੇ ਮੈਮ ਠੀਕ ਹੈ ਜੀ ਚੰਗਾ ਸਤਿ ਸ਼੍ਰੀ ਅਕਾਲ ਜੀ